ਹਾਂਜੀ ਹਾਂਜੀ ਗੁਰਪਿੰਦਰ ਬੋਲ ਰਹੀ ਹਾਂ ਹਾਂਜੀ ਬੋਲੋ ਹਾਂਜੀ ਹਾਂਜੀ ਜ਼ਰੂਰ ਦਲਜੀਤ ਦੁਸਾਂਝ ਅਤੇ ਗਿੱਪੀ ਗਰੇਵਾਲ ਇਹਨਾਂ ਨੇ ਬਹੁਤ ਵਧੀਆ ਫਿਲਮਾਂ ਕੀਤੀਆਂ ਬੋਲੀਵੁੱਡ 'ਚ ਬਹੁਤ ਵਧੀਆ ਐਕਟਿੰਗ ਕੀਤੀ ਆ ਅਤੇ ਇਸ ਤੋਂ ਇਲਾਵਾ ਸੋਨੂੰ ਸੂਦ ਉਹਨਾਂ ਨੇ ਦੋਵੇਂ ਰੋਲ ਕੀਤੇ ਆ ਅਤੇ ਧਰਮਿੰਦਰ ਸਨੀ ਦਿਓਲ ਬੋਬੀ ਦਿਓਲ ਸੋਨਮ ਬਾਜਵਾ ਨੀਰੂ ਬਾਜਵਾ ਮੁਕੇਸ਼ ਕੁਮਾਰ ਪ੍ਰੇਮ ਚੋਪੜਾ ਇਹਨਾਂ ਸਾਰਿਆਂ ਨੇ ਬੋਲੀਵੁੱਡ ਅਤੇ ਹੋਲੀਵੁੱਡ ਦੋਨਾਂ ਵਿੱਚ ਕੰਮ ਕੀਤਾ ਹੈ ਇਹਨਾਂ ਨੂੰ ਅਵੋਡ ਵੀ ਮੁਲ ਮਿਲ ਚੁੱਕੇ ਹੈ ਹਾਂਜੀ ਅਤੇ ਇਹਨਾਂ ਨੇ ਐਕਟਿੰਗ ਵੀ ਬਹੁਤ ਵਧੀਆ ਕੀਤੀ ਹੈ ਕੰਮ ਇਹਨਾਂ ਦਾ ਬਹੁਤ ਵਧੀਆ ਹੈ ਲੋਕਾਂ ਨੂੰ ਪਸੰਦ ਆਇਆ ਵਾ ਹਾਂਜੀ ਅਤੇ ਹੋਰ ਵੀ ਬਹੁਤ ਕੁਝ ਇਹਨਾਂ ਨੇ ਮਤਲਬ ਕਿ ਗਾਣੇ ਬਣਾਏ ਆ ਗਾਣੇ ਬੋਲਦੇ ਵੀ ਆ ਜਿਵੇਂ ਕਿ ਗਿੱਪੀ ਗਰੇਵਾਲ ਗਾਣੇ ਬੋਲਦਾ ਹੈ ਐਕਟਿੰਗ ਵੀ ਕਰਦੇ ਆ ਹਾਂਜੀ ਹੋਰ ਕੁਛ ਹਾਂਜੀ ਧੰਨਵਾਦ ਜੀ